ਹਾਂ ਅਸੀਂ ਆਪਣੇ ਆਂਢ ਗਵਾਂਢ ਦੇ ਘਰਾਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਾਂ ਅਤੇ ਜਿਹੜੇ ਸੈਲਾਨੀ ਆਉਂਦੇ ਆ ਉਹਨਾਂ ਦੇ ਲਈ ਉਹ ਘਰਾਂ ਵਾਲੇ ਉਹਨਾਂ ਦਾ ਕਿੱਦਾਂ ਪ੍ਰਬੰਧ ਕਰਦੇ ਆ ਉਹਨਾਂ ਬਾਰੇ ਵੀ ਸਾਨੂੰ ਪੂਰੀ ਜਾਣਕਾਰੀ ਹੁੰਦੀ ਆ ਜਿਹੜੇ ਸੈਲਾਨੀ ਮਤਲਬ ਕਿ ਆਉਂਦੇ ਆ ਜੇਕਰ ਉਹ ਪਿੰਡਾਂ ਵਿੱਚ ਠਹਿਰਦੇ ਆ ਤਾਂ ਪਿੰਡਾਂ ਵਿੱਚ ਤੁਹਾਨੂੰ ਪਤਾ ਹੀ ਆ ਵੀ ਗੁਰਦੁਆਰੇ ਬਣੇ ਹੁੰਦੇ ਆ ਗੁਰਦੁਆਰਿਆਂ ਦੇ ਵਿੱਚ ਸਰਾਵਾਂ ਹੁ ਸਰਾਵਾਂ ਬਣੀਆਂ ਹੁੰਦੀਆਂ ਵਾ ਸੈਲਾਨੀ ਆਣ ਕੇ ਉੱਥੇ ਠਹਿਰਦੇ ਆ ਅਤੇ ਲੰਗਰ ਦਾ ਪ੍ਰਬੰਧ ਜਿਹੜਾ ਚੌਵੀ ਘੰਟੇ ਹੁੰਦਾ ਵਾ ਅਤੇ ਉਹਨਾਂ ਨੂੰ ਮਤਲਬ ਕਿ ਰੋਟੀ ਪਾਣੀ ਦੇ ਪ੍ਰਬੰਧ ਲਈ ਇੱਧਰ ਉੱਧਰ ਭਟਕਣਾ ਨਹੀਂ ਪੈਂਦਾ ਉਹ ਆਪਣਾ ਗੁਰੂ ਘਰੋਂ ਹੀ ਲੰਗਰ ਜਿਹੜਾ ਵਾ ਉਹ ਛੱਕ ਸਕਦੇ ਆ ਦੂਜੀ ਗੱਲ ਜੇਕਰ ਜਿਹੜੇ ਸੈਲਾਨੀ ਜਿਹੜੇ ਆ ਉਹ ਸ਼ਹਿਰ ਦੇ ਵਿੱਚ ਆਉਂਦੇ ਆ ਤਾਂ ਉਥੇ ਤੁਹਾਨੂੰ ਪਤਾ ਵਾ ਮੰਦਰ ਜਾਂ ਤੁਸੀਂ ਲਾ ਲਓ ਕਿ ਹੋਰ ਧਰਮਸ਼ਾ ਧਰਮਸ਼ਾਲਾ ਬਣੀਆਂ ਹੁੰਦੀਆਂ ਵਾ ਉਹ ਫਿਰ ਆ ਕੇ ਉੱਥੇ ਆਪਣਾ ਠਹਿਰਦੇ ਆ ਅਤੇ ਕਈ ਸੈਲਾਨੀ ਹੁੰਦੇ ਆ ਜਿਹੜੇ ਕਿ ਗਰਮੀਆਂ ਦੇ ਦਿਨਾਂ ਵਿੱਚ ਆਉਂਦੇ ਆ ਅਤੇ ਫਿਰ ਉਹਨਾਂ ਨੇ ਉਹਨਾਂ ਦੇ ਰਹਿਣ ਦੇ ਲਈ ਮਤਲਬ ਕਿ ਹੋਟਲ ਦਾ ਪ੍ਰਬੰਧ ਕੀਤਾ ਜਾਂਦਾ ਵਾ ਪਰ ਹੋਟਲ ਦੇ ਵਿੱਚ ਏ ਸੀ ਜਾਂ ਵੇਖਣ ਦੇ ਟੀ ਵੀ ਜਿਵੇਂ ਹੋ ਗਿਆ ਉਹਨਾਂ ਨੂੰ ਹੋਰ ਵੀ ਸਹੂਲਤਾਂ ਉੱਥੇ ਮਿਲਦੀਆਂ ਵਾ ਅਤੇ ਫਿਰ ਉਹ ਆਪਣਾ ਜਿਹੜਾ ਵਾ ਉੱਥੇ ਸ਼ਹਿਰ ਦੇ ਵਿੱਚ ਰਹਿ ਲੈਂਦੇ ਆ ਇਸ ਤਰ੍ਹਾਂ ਸੈਲਾਨੀ ਜਿਹੜੇ ਆ ਕਿ ਉਹ ਪਿੰਡਾਂ ਵਿੱਚ ਵੀ ਰਹਿ ਪੈਂਦੇ ਆ ਸ਼ਹਿਰਾਂ ਵਿੱਚ ਵੀ ਉਹਨਾਂ ਦੇ ਰਹਿਣ ਦੀ ਵਿਵਸਥਾ ਕੀਤੀ ਜਾਂਦੀ ਆ